ਮੇਰਾ ਨਾਮ ਅਨਮੋਲ ਸਿੰਘ ਹੈ ਮੈਂ ਸ਼੍ਰੀ ਮੁਕਤਸਰ ਸਾਹਿਬ ਦਾ ਨਿਵਾਸੀ ਹਾਂ ਕੁਝ ਲੋਕ ਬਹੁਤ ਸਾਰੇ ਵਹਿਮ ਭਰਮ ਮੰਨਦੇ ਹਨ ਸਾਡੇ ਇਲਾਕੇ ਵਿੱਚ ਵਹਿਮ ਭਰਮ ਦੇਖੇ ਜਾ ਚੁੱਕੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਹਿਮ ਭਰਮ ਦੁਨੀਆਂ ਵਿੱਚ ਫੈਲੇ ਹੋਏ ਹਨ ਜਿਵੇਂ ਕਿ ਬਿੱਲੀ ਕਾਲੀ ਬਿੱਲੀ ਦਾ ਰਸਤਾ ਕੱਟਣਾ ਅਤੇ ਕਬਰ 'ਤੇ ਮਿੱਟੀ ਪੁੱਟਣਾ ਇਹ ਬਹੁਤ ਹੀ ਸਾਡੀ ਕ੍ਰਿਤੀ ਦਾ ਭਾਰਤੀ ਕ੍ਰਿਤੀ ਦਾ ਦੁਸ਼ਮਣ ਬਣ ਚੁੱਕੇ ਹਨ ਵਹਿਮ ਭਰਮ ਇੱਕ ਦੁਸ਼ਮਣ ਦੀ ਤਰ੍ਹਾਂ ਸਾਬਿਤ ਹੋ ਜਾ ਰਹੇ ਹਨ ਅੱਜ ਦੀ ਦੁਨੀਆਂ ਵਿੱਚ ਸਿੱਖਿਆ ਇੱਕ ਅਜਿਹਾ ਮਾਧਿਅਮ ਹੈ ਕਿ ਵਹਿਮ ਭਰਮ ਨੂੰ ਜੜੋਂ ਮਿਟਾ ਰਹੀ ਹੈ ਸਿੱਖਿਆ ਨਾਲ ਹੀ ਵਹਿਮ ਭਰਮ ਦੂਰ ਹੁੰਦੇ ਹਨ ਅੱਜ ਕੱਲ੍ਹ ਦੇ ਲੋਕ ਵਹਿਮ ਭਰਮਾਂ ਦੀ ਵਹਿਮ ਭਰਮਾਂ ਦੀ ਸਥਿਤੀ ਨੂੰ ਦੂਰੋਂ ਭਜਾ ਰਹੇ ਹਨ ਵਹਿਮ ਭਰਮ ਕਰਨਾ ਸਾਡੀ ਜ਼ਿੰਦਗੀ ਵਿੱਚ ਇੱਕ ਸ਼ਾਮਿਲ ਹੋ ਗਿਆ ਹੈ ਪੁਰਾਤਨ ਸਮੇਂ ਤੋਂ ਹੀ ਵਹਿਮ ਭਰਮ ਲੋਕ ਕਰਦੇ ਆ ਰਹੇ ਹਨ ਲੋਕਾਂ ਨੂੰ ਜਾਗਰਿਤ ਕਰਨ ਲਈ ਸਿੱਖਿਆ ਇੱਕ ਵਹਿਮ ਭਰਮ ਨੂੰ ਘਟਾਉਣ ਦਾ ਮਾਧਿਅਮ ਬਣ ਚੁੱਕੀ ਹੈ ਮਜ਼ਬੂਤੀ ਮਜ਼ਬੂਤੀ ਲੋਕ ਵਹਿਮ ਭਰਮ ਨੂੰ ਛੱਡ ਸਕਦੇ ਹਨ ਵਹਿਮ ਭਰਮ ਇਹ ਦਵਾ ਦਵਾਈ ਨਾਲ ਸ ਸੈੱਟ ਨਹੀਂ ਹੁੰਦੀ ਸਗੋਂ ਕਿ ਵਹਿਮ ਭਰਮ ਨਾਲ ਸਿੱਖਿਆ ਨੂੰ ਪ੍ਰਕਾਸ਼ਿਤ ਕਰਨ ਲਈ ਵਹਿਮ ਭਰਮ ਭਜਾਇਆ ਜਾ ਸਕਦਾ ਹੈ ਭਾਰਤ ਦੇਸ਼ ਵਿੱਚ ਪ ਪੁਰਾਤਨ ਸਮੇਂ ਤੋਂ ਹੀ ਵਹਿਮ ਭਰਮ ਜ਼ਿਆਦਾ ਫੈਲੇ ਹੋਏ ਹਨ ਵਹਿਮ ਭਰਮ ਨੂੰ ਦੂਰ ਕਰਨ ਲਈ ਸਿੱਖਿਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਨਾਲ ਅਸੀਂ ਵਹਿਮ ਭਰਮ ਨੂੰ ਦੂਰ ਪਹੁੰਚਾ ਸਕਦੇ ਹਨ ਜਿਵੇਂ ਕਿ ਕਾਲੀ ਬਿੱਲੀ ਰਸਤਾ ਕੱਟਨਾ ਕੱਟਦੀ ਹੈ ਜਾਣੀ ਕਿ ਭਾਵ ਉਹ ਆਪਣਾ ਰਸਤਾ ਪਾਰ ਕਰਦੀ ਹੈ ਪਰ ਸਾਨੂੰ ਲੱਗਦਾ ਹੈ ਕਿ ਸਾਡੇ ਲਈ ਕੁਝ ਮਾੜਾ ਹੋ ਰਿਹਾ ਹੈ